ਹੈਲੋ ਹਾਂਜੀ ਨਮਸ਼ਕਾਰ ਮੈਮ ਹਾਂਜੀ ਹਾਂਜੀ ਜ਼ਰੂਰ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਦੱਸੋ ਸਾਨੂੰ ਅੱਛਾ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਕਰਨੀ ਹੈ ਅੱਛਾ ਕਿੱਥੋਂ ਦੱਸਿਆ ਸੀ ਤੁਸੀਂ ਕਿੱਥੋਂ ਆਏ ਹੋ ਅੱਛਾ ਅੱਛਾ ਆ ਹਾਂਜੀ ਆਪਣੇ ਇੱਥੇ ਫਾਜ਼ਿਲਕਾ 'ਚ ਬਹੁਤ ਗੁਰਦਆਰਾ ਸਾਹਿਬ ਹੈਗੇ ਨੇ ਅਤੇ ਕੁਛ ਰਹਿਣ ਵਾਸਤੇ ਵੀ ਹੈਗੇ ਨੇ ਕਿਤੇ ਕਿਤੇ ਰਹਿਣ ਦਾ ਪ੍ਰਬੰਧ ਨਹੀਂ ਹੈਗਾ ਕਿਤੇ ਲੰਗਰ ਦੀ ਵਿਵਸਥਾ ਹੈਗੀ ਹੈ ਪਰ ਕਿਤੇ ਨਹੀਂ ਹੈਗੀ ਪਰ ਮੈਂ ਤੁਹਾਨੂੰ ਕਿਸ ਤਰੀਕੇ ਦਾ ਗੁਰਦੁਆਰਾ ਦੱਸਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਣੇ ਇੱਕ ਤਾਂ ਹੈਗਾ ਨਾ ਗਊਸ਼ਾਲਾ ਰੋਡ 'ਤੇ ਹੈਗਾ ਸਿੰਘ ਸਭਾ ਗੁਰਦੁਆਰਾ ਸਾਹਿਬ ਮੇਨ ਰੋਡ 'ਤੇ ਆ ਬਹੁਤ ਵਧੀਆ ਹੈਗਾ ਤੁਹਾਨੂੰ ਮਤਲਬ ਜ਼ਿਆਦਾ ਦਿੱਕਤ ਵੀ ਨਹੀਂ ਆਏਗੀ ਉੱਥੇ ਪਰ ਉੱਥੇ ਨਾ ਮਤਲਬ ਲੰਗਰ ਦਾ ਪ੍ਰਬੰਧ ਨਹੀਂ ਹੋਏਗਾ ਤੁਸੀਂ ਰਹਿ ਸਕਦੇ ਹੋ ਉੱਥੇ ਹਾਂਜੀ ਹਾਂਜੀ ਹੈਗੇ ਹੈ ਮੈਂ ਦੱਸਦੀ ਹਾਂ ਅਤੇ ਇੱਕ ਆਪਣੇ ਹੈਗੇ ਹੈ ਇੱਧਰ ਹਨੂੰਮਾਨ ਮੰਦਿਰ ਦੇ ਸਾਹਮਣੇ ਟਰੱਕ ਯੂਨੀਅਨ ਹੈਗਾ ਜਦੋਂ ਆਪਾਂ ਇੱਧਰ ਇੱਧਰ ਆਉਂਦੇ ਹਾਂ ਅਬੋਹਰ ਵਾਲੀ ਸਾਈਡ ਤੋਂ ਫਾਜ਼ਿਲਕਾ ਵੱਲ ਆਉਂਦੇ ਹਾਂ ਤਾਂ ਰਸਤੇ 'ਚ ਹਨੂੰਮਾਨ ਮੰਦਿਰ ਆਉਂਦਾ ਅਤੇ ਉੱਥੇ ਨਾ ਮਤਲਬ ਉਹਦੇ ਸਾਹਮਣੇ ਟਰੱਕ ਯੂਨੀਅਨ ਹੈ ਅਤੇ ਟਰੱਕ ਯੂਨੀਅਨ ਦੇ ਬੈਕ ਸਾਈਡ ਗੁਰਦੁਆਰਾ ਸਾਹਿਬ ਹੈਗੇ ਐ ਗੁਰੂ ਤੇਗ ਬਹਾਦਰ ਉਹ ਗੁਰਦੁਆਰਾ ਹਾਂਜੀ ਉਹ ਗੁਰਦੁਆਰਾ ਸਾਹਿਬ 'ਚ ਸਾਰਾ ਕੁਛ ਤੁਹਾਨੂੰ ਮਿਲ ਜਾਏਗਾ ਆਰਾਮ ਨਾਲ ਰਹਿ ਵੀ ਸਕਦੇ ਹੋ ਖਾਣ ਨੂੰ ਮਤਲਬ ਲੰਗਰ ਵਗੈਰਾ ਵੀ ਚਲਦਾ ਹੋਏਗਾ ਤੁਸੀਂ ਆਰਾਮ ਨਾਲ ਉੱਥੇ ਮਤਲਬ ਰਹਿ ਸਕਦੇ ਹੋ ਅਤੇ ਉਹ ਵੀ ਨਹੀਂ ਤਾਂ ਇੱਕ ਹੋਰ ਹੈਗੇ ਹੈ ਉਹ ਹੈਗਾ ਆਪਣੇ ਮਤਲਬ ਕਿੱਥੇ ਸੀ ਮਤਲਬ ਉਹ ਫਾਜ਼ਿਲਕਾ ਦੇ ਵਿੱਚ ਬਸ ਸਟੈਂਡ ਹੈਗਾ ਨਾ ਜਿੱਥੇ ਤੁਸੀਂ ਬਸ ਉਤਰੇ ਉਤਰੋਗੇ ਹਾਂ ਅਤੇ ਬਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਹੈ ਹਾਂਜੀ ਹਾਂਜੀ ਬਿਲਕੁਲ ਹਾਂਜੀ ਨੇੜੇ ਵੀ ਹੈ ਪਰ ਨਾ ਉੱਥੇ ਸ਼ਾਇਦ ਨਾ ਮਤਲਬ ਹੁਣ ਮੈਨੂੰ ਯਾਦ ਨਹੀਂ ਪਹਿਲਾਂ ਤਾਂ ਉੱਥੇ ਜਿਵੇਂ ਉਹ ਚੱਲਦਾ ਸੀ ਆਪਣੇ ਲੰਗਰ ਵਗੈਰਾ ਆਸਾਨੀ ਨਾਲ ਮਿਲ ਜਾਂਦਾ ਸੀ ਰਹਿਣ ਦੀ ਵਿਵਸਥਾ ਸੀ ਹੁਣ ਮੈਨੂੰ ਇੰਨਾ ਤਾਂ ਪਤਾ ਵੀ ਰਹਿਣ ਦੀ ਵਿਵਸਥਾ ਤਾਂ ਹੈਗੀ ਹੈ ਪਰ ਮੈਨੂੰ ਇਹ ਨਹੀਂ ਪਤਾ ਵੀ ਉੱਥੇ ਲੰਗਰ ਦੀ ਵਿਵਸਥਾ ਹੈਗੀ ਹੈ ਕਿ ਨਹੀਂ ਹੈਗੀ ਹਾਂਜੀ ਨੇੜੇ ਮੈਂ ਤੁਹਾਨੂੰ ਥੋੜ੍ਹੀ ਦੇਰ ਤੱਕ ਚੰਗੀ ਤਰ੍ਹਾਂ ਪੁੱਛ ਕੇ ਦੱਸ ਦਊਗੀ ਬਾਕੀ ਗੁਰਦੁਆਰਾ ਸਾਹਿਬ ਆਪਣੇ ਹੋਰ ਵੀ ਬਥੇਰੇ ਹੈਗੇ ਹੈ ਫਾਜ਼ਿਲਕਾ ਦੇ ਵਿੱਚ ਇੱਧਰ ਆਪਾਂ ਕਾਸਮੰਡੀ ਜਾਂਦੇ ਹਾਂ ਉੱਥੇ ਵੀ ਗੁਰਦੁਆਰਾ ਸਾਹਿਬ ਹੈਗੇ ਐ ਓਕੇ ਹਾਂਜੀ ਕੋਈ ਗੱਲ ਨਹੀਂ ਥੈਂਕ ਯੂ ਸੋ ਮਚ